ਮੇਰੇ ਸਾਈਕਲ ਦੀ ਰੂਟ ਦਾ ਨਜੀਠੀਆ ਜਿੱਥੋਂ ਮੈਂ ਆਪਣੇ ਸਾਈਕਲ ਤੋਂ ਸਫਰ ਕੀਤਾ ਜਲੰਧਰ ਤੋਂ ਚਿੰਤਪੁਰਨੀ ਜੋ ਕਿ ਅੱਸੀ ਕਿਲੋਮੀਟਰ ਦੀ ਦੂਰੀ 'ਤੇ ਹੈ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਪਹਾੜ ਦਰਖਤ ਦ੍ਰਿਸ਼ ਵੀ ਆਉਂਦੇ ਹਨ ਜਿਹਨਾਂ ਵਿੱਚ ਅਸੀਂ ਜਾਂਦੇ ਬਹੁਤ ਇੰਜੋਏ ਕਰੀਦਾ ਨੇ ਇਸ ਦੇ ਦੌਰਾਨ ਮੈਂ ਆਪਣੇ ਇਸ ਰੂਟ ਨੂੰ ਬਹੁਤ ਸੋਹਣੀਆਂ ਸੁੰਦਰ ਸੜਕਾਂ ਬਹੁਤ ਸੋਹਣੇ ਝਰਨੇ ਬਹੁਤ ਸੋਹਣੇ ਪਾਣੀ ਬਹੁਤ ਮਤਲਬ ਕਿ ਖੂਬਸੂਰਤ ਓਹ ਦਰਖਤ ਖੂਬਸੂਰਤ ਬਾਗ ਵੀ ਹਨ ਜਿਸ ਕਾਰਨ ਮੈਂ ਬਹੁਤ ਪ੍ਰਭਾਵਸ਼ਾਲੀ ਇਹ ਇਹਨਾਂ ਚੀਜ਼ਾਂ ਦਾ ਦ੍ਰਿਸ਼ ਦੇਖ ਕੇ ਹੁੰਦਾ ਵਾ ਉਸ ਤੋਂ ਉੱਪਰ ਚਿੰਤਪੁਰਨੀ ਤੋਂ ਜਵਾਲਾ ਜੀ ਤੱਕ ਚਾਲ੍ਹੀ ਕਿਲੋਮੀਟਰ ਦੀ ਦੂਰੀ ਹੈ ਇਹਦੇ ਵਿੱਚ ਥੋੜੀ ਜਿਹੀ ਕਠਿਨ ਹੋ ਜਾਂਦੀ ਹੈ ਪ੍ਰੀਖਿਆ ਜਿਹਦੇ ਵਿੱਚ ਚੜ੍ਹਾਈ ਥੋੜੀ ਔਖੀ ਹੁੰਦੀ ਹੈ ਇਹਦੇ ਵਿੱਚ ਵੀ ਬਹੁਤ ਸੋਹਣੇ ਦ੍ਰਿਸ਼ ਹੁੰਦੇ ਨੇ ਵਧੀਆ ਵਧੀਆ ਦਰਖਤ ਹੁੰਦੇ ਨੇ ਵਧੀਆ ਵਧੀਆ ਸੜਕਾਂ ਬਣਾਈਆ ਨੇ ਵਧੀਆ ਮਤਲਬ ਕਿ ਬਹੁਤ ਸੋਹਣਾ ਅਨੁਭਵ ਹੁੰਦਾ ਹੈ ਜਿਹਦੇ ਦੌਰਾਨ ਅਸੀਂ ਬਹੁਤ ਖੁਸ਼ ਹੁੰਦੇ ਹਾਂ